ਹੈਲੋ ਨਮਸਕਾਰ ਜੀ ਜੀ ਮੈਂ ਨਾ ਅੰਮ੍ਰਿਤਸਰ ਨਾ ਆਈ ਆਂ ਮਤਲਬ ਕਿ ਅਤੇ ਮੈਂ ਕੁਛ ਸ਼ੋਪਿੰਗ ਕਰਨੀ ਸੀਗੀ ਜਿਵੇਂ ਪੰਜਾਬੀ ਜੁੱਤੀਆਂ ਫੁਲਕਾਰੀ ਪੰਜਾਬੀ ਸੂਟ ਲੈਣੇ ਸੀਗੇ ਅਤੇ ਮੈਨੂੰ ਥੋੜ੍ਹਾ ਜਿਹਾ ਦੱਸੋਗੇ ਕਿ ਮੈਂ ਕਿਹੜੀ ਸਾਈਡ ਤੋਂ ਵਧੀਆ ਮਿਲ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਓਕੇ ਜੀ ਥੈਂਕ ਯੂ ਜੀ ਥੈਂਕ ਯੂ